ਪਹਿਲਾਂ ਮੋਹਾਲੀ ਜ਼ਿਲ੍ਹਾ ਯੋਗਦਾਨ ਕਾਰੋਬਾਰ ਵਿੱਚ ਕੁਝ ਖਾਸ ਵਿਕਾਸ ਨਹੀਂ ਸੀ ਪਰ ਅੱਜ ਇਹ ਜ਼ਿਲ੍ਹੇ ਐਨੇ ਇਨ੍ਹਾਂ ਸਭ ਚੀਜ਼ਾਂ ਵਿੱਚ ਮੰਨੇ ਪ੍ਰਮੰਨੇ ਹੈ ਇਸ ਨਾਲ਼ ਸਾਨੂੰ ਬਹੁਤ ਫਾਇਦਾ ਹੋਇਆ ਹੈ ਜਿਵੇਂ ਕਿ ਲੋੜਵੰਦ ਲੋਕਾਂ ਨੂੰ ਨੌਕਰੀਆਂ ਪ੍ਰਾਪਤ ਹੋਈਆਂ ਅਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਅਸਾਨੀ ਨਾਲ਼ ਪ੍ਰਾਪਤ ਹੋਣ ਲੱਗ ਗਈਆਂ ਜੇਕਰ ਮੈਂ ਗੱਲ ਕਰਾਂ ਚੁਣੌਤੀਆਂ ਦੀ ਤਾਂ ਇਸ ਨਾਲ਼ ਪੋਪੂਲੇਸ਼ਨ ਬਹੁਤ ਵੱਧ ਗਈ ਹੈ ਖੇਤੀਬਾੜੀ ਦਾ ਦਾਇਰਾ ਬਹੁਤ ਛੋਟਾ ਰਹਿ ਗਿਆ ਹੈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਚੀਜ਼ਾਂ 'ਤੇ ਗੌਰ ਕੀਤੀ ਜਾਵੇ